ਸਤਿ ਸ਼੍ਰੀ ਅਕਾਲ ਜੀ ਤੁਸੀਂ ਲੋਕਲ ਟੈਕਸੀ ਸਰਵਿਸ ਤੋਂ ਗੱਲ ਕਰ ਰਹੇ ਹੋ ਨਾ ਹਾਂਜੀ ਮੈਂ ਹਰਮਨਦੀਪ ਕੌਰ ਬੋਲ ਰਹੀ ਹਾਂ ਮੇਰੀ ਤੁਹਾਡੇ ਨਾਲ ਸ਼ਾਮੀ ਕੱਲ੍ਹ ਗੱਲ ਹੋਈ ਸੀਗੀ ਵੀ ਤੁਸੀਂ ਸਵੇਰੇ ਪੰਜ ਵਜੇ ਸਾਨੂੰ ਅੰਮ੍ਰਿਤਸਰ ਜਾਣਾ ਸੀ ਲੈ ਜਾਉਂਗੇ ਹੁਣ ਜਿੱਦਾਂ ਆਪਣੀ ਕੱਲ੍ਹ ਗੱਲ ਹੋਈ ਸੀ ਤਾਂ ਮੈਂ ਤੁਹਾਡੀ ਕਦੋਂ ਦੀ ਵੇਟ ਕਰ ਰਹੀ ਹਾਂ ਸਾਢੇ ਛੇ ਹੋ ਚੁੱਕੇ ਆ ਬਟ ਤੁਸੀਂ ਹੁਣ ਤੱਕ ਕੋਈ ਨਹੀਂ ਆਇਆ ਹੈਗਾ ਸੋ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਤੁਹਾਡੇ ਕਰਕੇ ਸਾਨੂੰ ਸੀਗਾ ਵੀ ਤੁਸੀਂ ਸਵੇਰੇ ਪਹੁੰ ਤੁਸੀਂ ਕਹਿੰਦੇ ਸੀ ਵੀ ਪਹੁੰਚ ਜਾਉਂਗੇ ਟਾਈਮ ਤੋਂ ਪਹਿਲਾਂ ਪਰ ਤੁਸੀਂ ਹੁਣ ਤੱਕ ਨਹੀਂ ਪਹੁੰਚੇ ਤਾਂ ਫਿਰ ਸਾਡੇ ਲਈ ਉੱਥੇ ਤੱਕ ਜਾਣਾ ਪਹਿਲਾਂ ਬਹੁਤ ਦੇਰ ਲੱਗ ਜਾਣੀ ਆ ਸਾਨੂੰ ਤਾਂ ਫਿਰ ਇਸ ਕਰਕੇ ਹੁਣ ਸਾਨੂੰ ਲੱਗ ਰਿਹਾ ਕਿ ਤੁਹਾਡੇ ਤੋਂ ਅਸੀਂ ਨਹੀਂ ਕਰਾਂਗੇ ਸਾ ਜਿਹੜੀ ਵੀ ਟੈਕਸੀ ਦੀ ਸਰਵਿਸ ਹੈ ਸੋ ਸਾਡਾ ਆਖਰੀ ਖਿਆਲ ਇਹ ਹੀ ਹੈ ਕਿ ਅਸੀਂ ਤੁਹਾਡੇ ਤੋਂ ਜਿਹੜੀ ਬੁੱਕ ਕਰਵਾਈ ਸੀ ਸਾਡੀ ਪੂਰੀ ਫੈਮਿਲੀ ਦੀ ਸਿਕਸ ਮੈਂਬਰਸ ਦੀ ਜਿਹੜੀ ਸੀਗੀ ਸਾਡੀ ਟਿਕਟ ਕਰਵਾਈ ਸੀ ਤੁਹਾਡੀ ਕੈਬ ਦੇ ਦੁਆਰਾ ਉਹ ਅਸੀਂ ਰੱਦ ਕਰਨਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਸਹੀ ਨਹੀਂ ਲੱਗ ਰਿਹਾ ਸਾਨੂੰ ਜਾਣ ਵਿੱਚ ਬਹੁਤ ਦੇਰੀ ਹੋ ਗਈ ਹੈ ਅਸੀਂ ਤੁਹਾਨੂੰ ਇਹੀ ਕਹਾਂਗੇ ਕਿ ਅੱਗੇ ਤੋਂ ਕਿਸੇ ਵੀ ਆਪਣੇ ਯਾਤਰੀਆਂ ਨਾਲ ਇੱਦਾਂ ਦਾ ਨਾ ਕਰਿਓ ਬਿਕੋਜ਼ ਕਿਉਂਕਿ ਯਾਤਰੀਆਂ ਦੇ ਲਈ ਆਪਣੇ ਟਾਈਮ ਸਿਰ ਆਪਣੇ ਸਥਾਨ 'ਤੇ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ ਹੈ ਸਾਨੂੰ ਤੁਹਾਡੇ ਤੋਂ ਬਹੁਤ ਨਿਰਾਸ਼ਾ ਹੋਈ ਹੈ ਤਾਂ ਫਿਰ ਅਸੀਂ ਚਾਹੁੰਦੇ ਹਾਂ ਕਿ ਅੱਗੇ ਤੁਸੀਂ ਆਪਣਾ ਕੰਮ ਸਹੀ ਢੰਗ ਨਾਲ ਕਰੋ ਅਤੇ ਸਾਡੀ ਜੋ ਸੀਗੀ ਸਾਰੀ ਕੈਬ ਦੀ ਉਹ ਬੁੱਕ ਕਰ ਬੁੱਕ ਕੀਤੀ ਹੋਈ ਸਾਰੀ ਰੱਦ ਕਰ ਦਿੱਤੀ ਜਾਵੇ ਧੰਨਵਾਦ